ਯੋਗ ਮੈਂ ਸ਼ੁਰੂ ਤੋਂ ਲੈ ਕੇ ਬਚਪਨ ਤੋਂ ਹੀ ਲੈ ਕੇ ਹੀ ਆਪਣੇ ਯੋਗ ਦਾ ਅਭਿਆਸ ਕਰਦਾ ਸੀ ਯਾਰਾਂ ਦੋਸਤਾਂ ਨੂੰ ਦੇਖਦਾ ਹੀ ਸਕੂਲ ਵਿੱਚ ਸਾਨੂੰ ਯੋਗ ਸਿਖਾਇਆ ਜਾਂਦਾ ਸੀ ਅਤੇ ਮੈਨੂੰ ਤਾਂ ਬਹੁਤ ਹੀ ਅੱਛਾ ਲੱਗਿਆ ਕਿ ਯੋਗ ਨਾਲ ਕਿੰਨੀਆਂ ਹੀ ਬਿਮਾਰੀਆਂ ਦੂਰ ਹੁੰਦੀਆਂ ਬੰਦਾ ਮੈਂਟਲੀ ਠੀਕ ਰਹਿੰਦਾ ਫਿਜੀਕਲੀ ਠੀਕ ਰਹਿੰਦਾ ਪੇਟ ਉਹਦਾ ਠੀਕ ਰਹਿੰਦਾ ਤਾਂ ਕਿਉਂ ਨਾ ਅਸੀਂ ਇਹ ਮੁਫ਼ਤ ਦੀ ਚੀਜ਼ ਹਰ ਕਿਸੇ ਨੂੰ ਅਪਣਾਉਣੀ ਚਾਹੀਦੀ ਹੈ ਯੋਗ ਕਿਉਂਕਿ ਯੋਗ ਯੋਗ ਕਹਿੰਦੇ ਨਾ ਕਰੋ ਯੋਗ ਅਤੇ ਭਜਾਓ ਰੋਗ ਇਹਦੇ ਨਾਲ ਬਿਮਾਰੀਆਂ ਦੂਰ ਨਹੀਂ ਆਉਣਗੀਆਂ ਦੂਰ ਦੂਰ ਭੱਜਣਗੀਆਂ ਅਤੇ ਅਸੀਂ ਬਿਲਕੁਲ ਸਵੱਸਥ ਰਹਾਂਗੇ ਸਾਨੂੰ ਡਾਕਟਰਾਂ ਦੇ ਪੈਸੇ ਵੀ ਬਚਣਗੇ ਅਤੇ ਯੋਗ ਨਾਲ ਬੜੇ ਬੜੇ ਰੋਗ ਦੂਰ ਹੋ ਜਾਂਦੇ ਆ ਬਿਨਾਂ ਪੈਸੇ ਪੈਸੇ ਤੋਂ ਹੀ ਕੈਂਸਰ ਲਕਵਾ ਹਾਰਟ ਬਰੇਨ ਹੈਂਜੀ ਅਤੇ ਇਸ ਵਿੱਚ ਯੋਗ ਨਾਲ ਮੈਂ ਤਾਂ ਆਪਣਾ ਅਨੁਭਵ ਮੇਰਾ ਇਹੋ ਹੀ ਹੈ ਕਿ ਜਿਹੜਾ ਯੋਗ ਹੈ ਨਾ ਹਰ ਇੱਕ ਬੱਚੇ ਤੋਂ ਲੈ ਕੇ ਬੁੱਢੇ ਨੂੰ ਜਨਾਨੀਆਂ ਹਰ ਕਿਸੇ ਨੂੰ ਯੋਗ ਨੂੰ ਕਰਨਾ ਚਾਹੀਦਾ ਸਵੇਰੇ ਬੰਦਾ ਆਪਣੀ ਤਾਜ਼ੀ ਹਵਾ ਵਿੱਚ ਕੋਠੇ 'ਤੇ ਬਹਿ ਗਏ ਜਾਂ ਛੱਤ 'ਤੇ ਜਾਂ ਬਾਗ ਵਿੱਚ ਜਾ ਕੇ ਯੋਗ ਕਰੇ ਅਤੇ ਯੋਗ ਨਾਲ ਜਿਹੜਾ ਹੈ ਨਾ ਬਹੁਤ ਹੀ ਅੱਛਾ ਅਨੁਭਵ ਬੜਾ ਮਤਲਬ ਲਾਈਟ ਫੀਲ ਹੁੰਦਾ ਬੋਡੀ 'ਚ ਕਿ ਮੈਂ ਅੱਜ ਫੁੱਲਾਂ ਵਾਂਗੂ ਮਤਲਬ ਖਿਲਿਆ ਓ ਰਹਿੰਦਾ ਬੰਦਾ ਚਿਹਰੇ 'ਤੇ ਮੁਸਕਾਨ ਰਹਿੰਦੀ ਹੈ ਅਤੇ ਉਹਨੂੰ ਹੋਰ ਕੋਈ ਬਿਮਾਰੀਆਂ ਤੋਂ ਮੇਨ ਤਾਂ ਪਰਪਸ ਹੈ ਕਿ ਬਿਮਾਰੀਆਂ ਜਿਹੜੀਆਂ ਨਾ ਬਿਮਾਰੀਆਂ ਤੋਂ ਬੰਦਾ ਬਚਿਆ ਰਹਿੰਦਾ ਹੈ ਅਤੇ ਇਹ ਕਈ ਤਰ੍ਹਾਂ ਯੋਗ ਅਲੱਗ ਅਲੱਗ ਬਿਮਾਰੀ ਵਾਸਤੇ ਅਲੱਗ ਅਲੱਗ ਤਰ੍ਹਾਂ ਦੇ ਯੋਗ ਪਸ਼ੁਮਤਾਨ ਆਸਨ ਸਰਵਾਂਗ ਆਸਨ ਧਨੂਰ ਆਸਨ ਸਰਬ ਆਸਨ ਬਕੁਟ ਆਸਨ ਹੈ ਜੀ ਅਤੇ ਇਹ ਇਸ 'ਤੇ ਹਰ ਕਿਸੇ ਪ੍ਰਾਣੀ ਨੂੰ ਯੋਗ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਹਰ ਇੱਕ ਪ੍ਰਾਣੀ ਕਰੋ ਯੋਗ ਭਗਾਓ ਰੋਗ ਥੈਂਕ ਯੂ